ਬੋਲੀਵੁੱਡ ਅਤੇ ਟੋਲੀ ਵਿੱਚ ਨੇ ਭਾਰਤ ਵਿੱਚ ਨੂੰ ਬਹੁਤ ਫੈਸ਼ਨ ਦਿੱਤਾ ਅਤੇ ਜ਼ਿਆਦਾਤਰ ਭਾਰਤ ਵਿੱਚ ਬੋਲੀਵੁੱਡ ਨੂੰ ਹੀ ਤੋਂ ਹੀ ਫੈਸ਼ਨ ਨੂੰ ਕਾਪੀ ਕੀਤਾ ਜਾਂਦਾ ਅਤੇ ਜ਼ਿਆਦਾਤਰ ਲੋਕ ਫਿਲਮਾਂ ਤੋਂ ਹੀ ਜਾਂ ਟੀਵੀ ਤੋਂ ਸੀਰੀਅਲ ਤੋਂ ਹੀ ਆਪਣਾ ਫੈਸ਼ਨ ਚੁਣਦੇ ਨੇ ਉਹਨਾਂ ਵਿੱਚੋਂ ਕਾਫੀ ਲੋਕ ਆਪਣਾ ਲਹਿੰਗਾ ਸਾੜੀ ਜੋ ਵੀ ਉਹਨਾਂ ਤੋਂ ਹੀ ਡਿਜ਼ਾਇਨ ਕਾਪੀ ਕਰਦੇ ਨੇ ਜਿਵੇਂ ਕਿ ਕੁਛ ਫਿਲਮਾਂ ਬਹੁਤ ਜ਼ਿਆਦਾ ਫੇਮਸ ਹੋਈਆਂ ਜਿਹਨਾਂ ਤੋਂ ਜਿਵੇਂ ਚਾਂਦਨੀ ਜਾਂ ਧਰਮਾ ਪ੍ਰੋਡਕਸ਼ਨ ਯਸ਼ਰਾਜ ਬੈਨਰ ਥੱਲੇ ਬਣੀਆਂ ਫਿਲਮਾਂ ਉਹਨਾਂ ਵਿੱਚ ਉਹਨਾਂ ਦੇ ਸ਼ਿਫੋਨ ਦੀਆਂ ਸਾੜੀਆਂ ਅਤੇ ਲਹਿੰਗੇ ਅਤੇ ਸੂਟਸ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਲੇਟੈਸਟ ਵਿੱਚ ਅੱਜ ਕੱਲ੍ਹ ਕਾਫੀ ਲਹਿੰਗੇ ਸ਼ਰਾਰੇ ਉਹਨਾਂ ਦਾ ਵਰਕ ਲੋਕ ਉਹਨਾਂ ਨੂੰ ਹੀ ਕਾਪੀ ਕਰਦੇ ਨੇ ਅਤੇ ਮੈਂ ਆਪਣੇ ਬੁਟੀਕ 'ਤੇ ਵੀ ਇਹਨਾਂ ਚੀਜ਼ਾਂ ਨੂੰ ਬਹੁਤ ਅੱਗੇ ਰੱਖ ਕੇ ਬਣਾਉਂਦੀ ਡਿਜ਼ਾਇਨ ਕਰਦੀ ਹਾ ਜਿਵੇਂ ਉਹਨਾਂ ਦਾ ਵਰਕ ਹੈ ਜਾਂ ਸ਼ਿਫੋਨ ਦੀ ਸਾੜੀਆਂ ਉੱਤੇ ਥਰੈਡ ਵਰਕ ਸੂਟਾਂ ਉੱਤੇ ਦੁਪੱਟੇ ਹਾਈਲਾਈਟ ਕਰਨੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਉਹ ਫਿਲਮਾਂ ਦੇ ਨਾਲ ਜੋ ਉਹਨਾਂ ਨੇ ਪਸੰਦ ਕੀਤਾ ਕਸਟਮਰ ਨੇ ਉਹਨੂੰ ਉਸ ਤਰ੍ਹਾਂ ਹੀ ਬਣਾ ਕੇ ਉਹਨਾਂ ਨੂੰ ਦਿੱਤਾ ਜਾਵੇ ਅਤੇ ਉਹ ਲੋਕ ਸ਼ੌਂਕ ਨਾਲ ਉਹਨਾਂ ਨੂੰ ਪਸੰਦ ਕਰਦੇ ਹਨ ਕਾਫੀ ਚੀਜ਼ਾਂ ਲੋਕ ਸੇਮ ਟੂ ਸੇਮ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਉਸੇ ਤਰ੍ਹਾਂ ਦਾ ਰੰਗ ਡਿਜਾਈਨ ਫੈਬਰਿਕ ਸਭ ਸੇਮ ਦਿੱਤਾ ਜਾਵੇ ਲੋਕ ਅੱਜ ਕੱਲ੍ਹ ਦੇ ਲੇਟੈਸਟ ਜੋ ਵੀ ਫਿਲਮਾਂ ਆ ਰਹੀਆਂ ਨੇ ਉਹਨਾਂ ਨੂੰ ਲੋਕ ਸੇਮ ਪਸੰਦ ਕਰਦੇ ਨੇ ਕਿ ਉਸ ਤਰ੍ਹਾਂ ਦੀ ਚੀਜ਼ ਦਿੱਤੀ ਜਾਵੇ ਅਤੇ ਅੱਜ ਕੱਲ੍ਹ ਜਿਹੜੀਆਂ ਹੋਰ ਨਵੀਆਂ ਚੀਜ਼ਾਂ ਜਿਵੇਂ ਹਮ ਆਪਕੇ ਹੈ ਕੋਨ ਤੋਂ ਲੋਕਾਂ ਨੇ ਮਾਧੁਰੀ ਦਿਕਸ਼ਿਤ ਦੇ ਬਣਾਏ ਪਹਿਨੇ ਲਹਿੰਗੇ ਸਾੜੀਆਂ ਜਾਂ ਸੂਟ ਲੋਕਾਂ ਨੇ ਬਹੁਤ ਕਾਪੀ ਕਰਵਾਏ ਬਹੁਤ ਪਸੰਦ ਕੀਤੇ ਅੱਜ ਵੀ ਲੋਕ ਉਹਨਾਂ ਨੂੰ ਜ਼ਿਆਦਾ ਇੰਡੀਆ ਵਿੱਚ ਇਹਦਾ ਜ਼ਿਆਦਾ ਚਲਨ ਹੈ ਥੈਂਕ ਯੂ